ਮੈਂ ਸ਼ਿਲਪਾ ਮੈਂ ਮਿਤੀ ਤਿੰਨ ਤਿੰਨ ਦੋ ਹਜ਼ਾਰ ਚੌਵੀ ਨੂੰ ਇੱਕ ਦੋ ਪ੍ਰੋਡਕਟ ਮੰਗਵਾਏ ਸੀ ਔਨਲਾਇਨ ਜਿਸ ਵਿੱਚੋਂ ਇੱਕ ਤਾਂ ਪ੍ਰੋਡਕਟ ਠੀਕ ਸੀ ਬਟ ਦੂਸਰਾ ਪ੍ਰੋਡਕਟ ਜੋ ਕਿ ਮੈਂ ਘੜੀ ਮੰਗਵਾਈ ਸੀ ਉਹ ਬਿਲਕੁਲ ਮਾੜੀ ਨਿਕਲੀ ਪਹਿਲਾਂ ਤਾਂ ਡਲਿਵਰੀ ਆਉਣ ਵਿੱਚ ਡਲਿਵਰੀ ਵਾਲੇ ਨੇ ਬਹੁਤ ਟਾਇਮ ਲਗਾ ਦਿੱਤਾ ਜ਼ਿਆਦਾਤਰ ਡਲਿਵਰੀ ਵਾਲੇ ਸੱਤ ਦਿਨ ਵਿੱਚ ਪ੍ਰੋਡਕਟ ਦੇ ਜਾਂਦੇ ਹਨ ਪਰ ਇਹ ਪ੍ਰੋਡਕਟ ਆਉਣ ਵਿੱਚ ਉਸਨੇ ਪੂਰੇ ਪੰਦਰਾਂ ਦਿਨ ਲਗਾ ਦਿੱਤੇ ਜਦੋਂ ਮੈਂ ਘੜੀ ਜੋ ਕਿ ਦੂਸਰਾ ਪ੍ਰੋਡਕਟ ਸੀ ਉਹ ਲੈ ਕੇ ਘਰ ਆਈ ਤਾਂ ਜਦ ਮੈਂ ਇਸਦੀ ਪੈਕਿੰਗ ਖੋਲਣ ਲੱਗੀ ਪਹਿਲਾਂ ਤਾਂ ਇਸਦੀ ਪੈਕਿੰਗ ਹੀ ਬਹੁਤ ਹੀ ਜ਼ਿਆਦਾ ਮਾੜੀ ਸੀ ਇਸ ਦਾ ਜੋ ਡਿੱਬਾ ਸੀ ਉਹ ਵੀ ਸਾਰਾ ਫਟਿਆ ਹੋਇਆ ਸੀ ਜਦੋਂ ਮੈਂ ਘੜੀ ਖੋਲ ਕੇ ਵੇਖੀ ਤਾਂ ਘੜੀ ਦਾ ਇੱਕ ਪਾਸੋਂ ਬੱਦਰਾ ਵੀ ਟੁੱਟਿਆ ਹੋਇਆ ਸੀ ਅਤੇ ਉਸ ਦੀਆਂ ਜੋ ਕਿ ਅੰਦਰਲੀਆਂ ਸੂਈਆਂ ਸਨ ਉਹ ਵੀ ਵਿੱਖਰੀਆਂ ਹੋਈਆਂ ਸੀ ਜਦੋਂ ਮੈਨੂੰ ਇਹ ਘੜੀ ਦੇਖ ਕੇ ਬਹੁਤ ਹੀ ਨਿਰਾਸ਼ਾ ਹੋਈ ਕਿਉਂਕਿ ਇਹ ਘੜੀ ਮੈਂ ਕਿਸੇ ਨੂੰ ਗਿਫ਼ਟ ਦੇਣੀ ਸੀ ਨਾ ਤਾਂ ਇਹ ਘੜੀ ਟਾਇਮ ਸਮੇਂ 'ਤੇ ਆਈ ਅਤੇ ਨਾ ਹੀ ਬੇ ਚੰਗੀ ਨਿਕਲੀ ਜਦੋਂ ਮੈਂ ਘੜੀ ਚਲਾਉਣ ਲੱਗੀ ਤਾਂ ਘੜੀ ਚੱਲ ਵੀ ਨਹੀਂ ਰਹੀ ਸੀ ਇਹ ਪ੍ਰੋਡਕਟ ਬਹੁਤ ਹੀ ਮਾੜਾ ਨਿਕਲਿਆ ਅਤੇ ਮੈਨੂੰ ਨਾ ਹੀ ਇਸਦੇ ਪੈਸੇ ਵਾਪਿਸ ਮਿਲੇ ਅਤੇ ਨਾ ਹੀ ਘੜੀ ਬਦਲ ਕੇ ਦਿੱਤੀ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਮਾੜਾ ਲੱਗ ਰਿਹਾ ਸੀ ਇਹ ਬਹੁਤ ਹੀ ਮਾੜਾ ਪ੍ਰੋਡਕਟ ਨਿਕਲਿਆ ਜ਼ਿਆਦਾਤਰ ਪ੍ਰੋਡਕਟ ਮੈਂ ਔਨਲਾਇਨ ਹੀ ਮੰਗਵਾਉਂਦੀ ਹਾਂ ਪਰ ਜੋ ਇਹ ਪ੍ਰੋਡਕਟ ਹੈ ਜੋ ਕਿ ਮੈਂ ਘੜੀ ਮੰਗਵਾਈ ਸੀ ਉਹ ਬਹੁਤ ਹੀ ਮਾੜੀ ਨਿਕਲੀ ਕਿਉਂਕਿ ਇਹ ਘੜੀ ਮੈਂ ਆਪਣੀ ਦੋਸਤ ਗਿਫ਼ਟ ਦੇਣੀ ਸੀ ਜਦੋਂ ਮੈਂ ਘੜੀ ਖੋਲ੍ਹ ਕੇ ਵੇਖੀ ਤਾਂ ਇਸ ਦੀਆਂ ਸਾਰੀਆਂ ਹੀ ਸੂਈਆਂ ਵਿੱਖਰੀਆਂ ਹੋਈਆਂ ਸੀ ਇਹ ਪ੍ਰੋਡਕਟ ਬਹੁਤ ਹੀ ਮਾੜਾ ਨਿਕਲਿਆ